ਮੈਂ ਡੇਲੀ ਸ਼ਾਮ ਨੂੰ ਪੰਜ ਕਿਲੋਮੀਟਰ ਦੀ ਰਨਿੰਗ ਕਰਦਾ ਹਾਂ ਮੈਂ ਸ਼ਾਮ ਨੂੰ ਛੇ ਵਜੇ ਗਰਾਊਂਡ ਚਲ ਜਾਂਦਾ ਅਤੇ ਸਭ ਤੋਂ ਪਹਿਲਾਂ ਉੱਥੇ ਜਾ ਕੇ ਵਾਮਅਪ ਹੁੰਦਾ ਅਤੇ ਦੌੜਨ ਦਾ ਸਾਡੀ ਜ਼ਿੰਦਗੀ ਵਿਚ ਕਾਫੀ ਮਹੱਤਵ ਹੈ ਮੇਰਾ ਮੇਨ ਮੋਟਿਵ ਪੰਜਾਬ ਪੁਲਿਸ ਵਿੱਚ ਸਲੈਕਟ ਹੋਣਾ ਹੈ ਅਤੇ ਮੈਂ ਡੇਲੀ ਗਰਾਊਂਡ ਜਾਂਦਾ ਹੈ ਅਤੇ ਪੰਜ ਕੁ ਮਿੰਟ ਰਨਿੰਗ ਕਰਦਾ ਹੈ ਅਤੇ ਜਿਸ ਕਰਕੇ ਜਿਸ ਕਰਕੇ ਮੇਰਾ ਸਟੈਮੀਨਾ ਡੇ ਬਾਏ ਡੇ ਬਿਲਡਅੱਪ ਹੋ ਰਿਹਾ ਹੈ ਇੱਕ ਵਧੀਆ ਵਧੀਆ ਰਨਿੰਗ ਕਰਨ ਲਈ ਪੰਜ ਮਿੰਟ ਦੀ ਰਨਿੰ ਪੰਜ ਕਿਲੋਮੀਟਰ ਦੀ ਰਨਿੰਗ ਪੱਚੀ ਪੱਚੀਆ ਮਿੰਟਾਂ ਵਿੱਚ ਹੋਣੀ ਜ਼ਰੂਰੀ ਹੈ ਅਤੇ ਮੈਂ ਮੇਰੇ ਦੌੜਨ ਦਾ ਮੇਨ ਮਕਸਦ ਪੰਜਾਬ ਪੁਲਿਸ 'ਚ ਸਿਲੈਕਟ ਹੋਣਾ ਹੈ ਜੇਕਰ ਬਿਨਾਂ ਦੌੜ ਤੇ ਮੈਂ ਪੰਜਾਬ ਪੁਲਿਸ ਦਾ ਫਿਜੀਕਲ ਦੇਣ ਲਈ ਇਲੀਜਬਲ ਨਹੀਂ ਹੋਵਾਂਗਾ ਅਤੇ ਜੇਕਰ ਮੇਰੀ ਪੰਜਾਬ ਪੁਲਿਸ ਵਿੱਚ ਜੋਬ ਲੱਗਦੀ ਹੈ ਤਾਂ ਮੇਰੇ ਇੱਕ ਸੁਖਲਾਵਾਂ ਜੀਵਨ ਹੋਵੇਗਾ ਅਤੇ ਮੈਂ ਆਪਣੇ ਜੀਵਨ ਵਿੱਚ ਕਾਫੀ ਕਾਫੀ ਅ ਕਾਫੀ ਕੁਛ ਖਰੀਦ ਸਕਦਾ ਹਾਂ ਅਤੇ ਆਪਣੇ ਸ਼ੌਂਕ ਪੂਰੇ ਕਰ ਸਕਦਾ ਹਾਂ ਅਤੇ ਆਪਣੇ ਫੈਮਿਲੀ ਦੇ ਵੀ ਸ਼ੌਂਕ ਪੂਰੇ ਕਰ ਸਕਦਾ ਹਾਂ ਅਤੇ ਇਹ ਤਾਂ ਜੋਬ ਲੈਣ ਦੀ ਗੱਲ ਹੋ ਗਈ ਹੈ ਅਦਰਵਾਈਜ਼ ਦੌੜਨ ਦਾ ਉਸ ਸਾਨੂੰ ਡੇਲੀ ਦੌੜਨਾ ਚਾਹੀਦਾ ਹੈ ਅਤੇ ਦੌੜਨ ਨਾਲ ਸਾਡਾ ਦਿਲ ਵਧੀਆ ਰਹਿੰਦਾ ਹੈ ਅਤੇ ਦਿਮਾਗ ਵੀ ਵਧੀਆ ਰਹਿੰਦਾ ਹੈ ਧੰਨਵਾਦ